ਮੈਂ ਸੋਚਦਾ ਹਾਂ ਕਿ ਮੇਰੀ ਇੱਕ ਸ਼ਕਤੀ ਇਹ ਹੈ ਕਿ ਮੈਨੂੰ ਕਿਤੇ ਵੀ ਖੜ੍ਹਾ ਕਰ ਦਿੱਤਾ ਜਾਵੇ ਮੈਂ ਕਿਸੇ ਵੀ ਟੋਪਿਕ ਬਾਰੇ ਕੁਛ ਵੀ ਬੋਲ ਸਕਦਾ ਹਾਂ ਮੇਰੇ ਵਿੱਚ ਇੰਨਾ ਕੋਂਨਫੀਡੈਂਸ ਹੈ ਅਤੇ ਇਸ ਕੋਂਨਫੀਡੈਂਸ ਕਰਕੇ ਜੋ ਮੈਂ ਇੱਕ ਲੋਅ ਸਟੂਡੈਂਟ ਬਣਿਆ ਜਿਸ ਦਾ ਮੈਨੂੰ ਬਹੁਤ ਫ਼ਾਇਦਾ ਹੋਇਆ ਹੈ ਇਹ ਕੋਂਨਫੀਡੈਂਸ ਅਤੇ ਇਹ ਸ਼ਕਤੀ ਮੈਨੂੰ ਮੇਰੇ ਲੋਅ ਸਟੂਡੈਂਟ ਹੋਣ ਦੇ ਵਿੱਚ ਬਹੁਤ ਮਦਦ ਕਰਦੀ ਹੈ ਮੈਂ ਖਿ ਮੈਨੂੰ ਕਿਤੇ ਵੀ ਲੋੜ ਹੋਵੇ ਮੈਂ ਆਪਣਾ ਪੱਖ ਰੱਖ ਸਕਦਾ ਹਾਂ ਅਤੇ ਮੇਰੇ ਵਿੱਚ ਇੱਕ ਦੂਜੀ ਸ਼ਕਤੀ ਇਹ ਹੈ ਕਿ ਮੈਂ ਬਹੁਤ ਹੀ ਮਦਦਗਾਰ ਹਾਂ ਅਗਰ ਕਿਸੇ ਨੂੰ ਮੇਰੇ ਤੋਂ ਕੋਈ ਵੀ ਮਦਦ ਦੀ ਲੋੜ ਹੋਵੇ ਮੈਂ ਹਮੇਸ਼ਾ ਸਾਹਮਣੇ ਆਵਾਂਗਾ ਅਤੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗਾ ਕਿ ਜਿੰਨਾ ਮੇਰੇ ਤੋਂ ਹੋ ਸਕਦਾ ਐ ਮੈਂ ਉੰਨੀ ਉਸ ਇਨਸਾਨ ਦੀ ਮਦਦ ਕਰਾਂ ਪਰ ਮੇਰੇ ਵਿੱਚ ਕੁਛ ਖਾਮੀਆਂ ਵੀ ਹਨ ਜਿੱਦਾਂ ਕਿ ਮੈਂ ਫੋਨ ਬਹੁਤ ਚਲਾਉਂਦਾ ਰਾਤ ਰਾਤ ਭਰ ਬੈਠਾ ਮੈਂ ਫੋਨ ਚਲਾਉਂਦਾ ਰਹਿੰਦਾ ਹਾਂ ਰੀਲਾਂ ਦੇਖਦਾ ਰਹਿੰਦਾ ਹਾਂ ਜਿਸ ਨਾਲ ਮੇਰੀਆਂ ਅੱਖਾਂ 'ਤੇ ਵੀ ਅਸਰ ਹੋਇਆ ਹੈ ਅਤੇ ਮੇਰੀ ਨੀਂਦ ਵੀ ਨਹੀਂ ਪੂਰੀ ਹੁੰਦੀ ਅਤੇ ਮੇਰੀ ਇੱਕ ਖਾਮੀ ਇਹ ਹੈ ਕਿ ਮੈਂ ਆਲਸੀ ਬਹੁਤ ਹਾਂ ਮੈਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਬਹੁਤ ਆਲਸ ਕਰਦਾ ਹਾਂ ਮੇਰਾ ਜੀਨ ਉੱਠਣ ਨੂੰ ਜੀ ਨਹੀਂ ਕਰਦਾ ਮੇਰਾ ਬਸ ਚੱਲੇ ਤਾਂ ਮੈਂ ਸਾਰਾ ਦਿਨ ਬੈਡ 'ਤੇ ਹੀ ਲੇਟਿਆ ਰਹਾਂ